ਹਾਂਜੀ ਜਿਵੇਂ ਅਲੱਗ ਅਲੱਗ ਮੁਕਾਬਲੇ ਹੋਏ ਮੈਂ ਕਢਾਈ ਦੇ ਮੁਕਾਬਲੇ ਵਿੱਚ ਆਪਣਾ ਹਿੱਸਾ ਲਿਆ ਸੀ ਉਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਸਟਿਚ ਦਿੱਤੇ ਹੋਏ ਸੀਗੇ ਜਿਨ੍ਹਾਂ ਦੇ ਆਧਾਰ 'ਤੇ ਆਪਾਂ ਨੇ ਇੱਕ ਮੋਡਲ ਜਿੱਦਾਂ ਮੋਡਲ ਦਾ ਚਿੱਤਰ ਤਿਆਰ ਕਰਨਾ ਸੀਗਾ ਉਹ ਮੈਨੇ ਬਣਾਇਆ ਸੀਗਾ ਉਹਦੇ 'ਚ ਅਲੱਗ ਅਲੱਗ ਮਤਲਬ ਕਿ ਸਟਿਚ ਕੀਤੇ ਮੈਨੇ ਜਿਵੇਂ ਰਨਿੰਗ ਸਟਿਚ ਹੋ ਗਿਆ ਬੈਕ ਸਟਿੱਚ ਹੋ ਗਿਆ ਨੋਟ ਸਟਿੱਚ ਹੋ ਗਿਆ ਹੇਮਿੰਗ ਸਟਿਚ ਹੋ ਗਿਆ ਅਲੱਗ ਅਲੱਗ ਤਰ੍ਹਾਂ ਦੇ ਥਰੈਡ ਵਰਤ ਕੇ ਜਿੱਦਾਂ ਉਹਦੇ ਹੇਅਰ ਵਗੈਰਾ ਬਣਾਏ ਉਹ ਆਪਣੇ ਬੈਕ ਸਟਿਚ ਦੇ ਨਾਲ ਬਣੀ ਸੀਗੀ ਅਲੱਗ ਅਲੱਗ ਤਰ੍ਹਾਂ ਦੇ ਮਤਲਬ ਕਿ ਥਰੈਡ ਯੂਜ ਕਰਕੇ ਜਿਹੜੀ ਉਹਦੀ ਫਰੋਕ ਸੀਗੀ ਉਹ ਅਲੱਗ ਤਰ੍ਹਾਂ ਦੀ ਬਣਾਈ ਸੀ ਜਿੱਦਾਂ ਕਲੀਆਂ ਵਾਲੀ ਕਲੀਆਂ ਵਾਲੀ ਫਰੋਕ ਹੁੰਦੀ ਹੈ ਉੱਦਾਂ ਕਲੀਆਂ ਸ਼ੋ ਕਰਕੇ ਉਹਦੀ ਫਰੋਕ ਬਣਾਈ ਸੀਗੀ ਮੈਨੇ ਆਪਣੀ ਅਲੱਗ ਕਲਾਕਾਰ ਹੀ ਦਿਖਾਈ ਸੀਗੀ ਉਹਦੇ ਵਿੱਚ ਅਤੇ ਮਤਲਬ ਕਿ ਮੇਰੀ ਉਹਦੇ ਵਿੱਚ ਸੈਕਿੰਡ ਪੋਜੀਸਨ ਸੀਗੀ ਸੈਕਿੰਡ ਪੋਜੀਸਨ ਇਸ ਕਰਕੇ ਸੀਗੀ ਕਿਉਂਕਿ ਮੇਰੇ ਤੋਂ ਥੋੜ੍ਹੀ ਬਹੁਤ ਮਿਸਟੇਕ ਹੋ ਗਈ ਸੀਗੀ ਅਤੇ ਮਿਸਟੇਕ ਕੀ ਹੋ ਗਈ ਸੀਗੀ ਜਿਹੜੇ ਉਹਦੇ ਹੇਅਰ ਸੀਗੇ ਉਹ ਮੇਰੇ ਤੋਂ ਚੰਗੀ ਤਰ੍ਹਾਂ ਮਤਲਬ ਕਿ ਨਹੀਂ ਹੋਏ ਅਤੇ ਲੈਂਥ ਦਿਖਾਣੀ ਸੀਗੀ ਲੈਂਥ ਮੇਰੇ ਤੋਂ ਸਹੀ ਤਰ੍ਹਾਂ ਨਹੀਂ ਦਿਖਾਈ ਗਈ ਇਸ ਕਰਕੇ ਮੇਰਾ ਥੋੜ੍ਹਾ ਜਿਹਾ ਮਤਲਬ ਕਿ ਦਿੱਕਤ ਆ ਗਈ ਅਤੇ ਉੱਦਾਂ ਆਲ ਓਵਰ ਵਧੀਆ ਸੀਗਾ ਮੇਰਾ ਬਹੁਤ ਜ਼ਿਆਦਾ ਮਤਲਬ ਕਿ ਵਧੀਆ ਰਿਹਾ